ਘੁੰਮਣ ਜਾਣ ਦਾ ਬਹੁਤ ਜ਼ਿਆਦਾ ਸ਼ੌਕੀਨ ਹਾਂ ਜਿਹਨਾਂ ਵਿੱਚੋਂ ਬਾਕੀ ਸਾਧਨਾਂ ਨੂੰ ਛੱਡ ਕੇ ਮੈਂ ਰੇਲਵੇ ਮਾਰਗ ਨੂੰ ਸਾਰਿਆਂ ਨਾਲੋਂ ਵੱਧ ਜ਼ਰੂਰੀ ਸਮਝੂਗਾ ਅਤੇ ਪ੍ਰੈਫਰੈਂਸ ਇਹਨੂੰ ਦੇਊਂਗਾ ਕਿਉਂਕਿ ਇੱਕ ਤਾਂ ਇਹ ਸਾਰਿਆਂ ਨਾਲੋਂ ਜ਼ਿਆਦਾ ਸਸਤਾ ਏ ਦੂਸਰਾ ਜਿੱਥੇ ਵੀ ਤੁਸੀਂ ਘੁੰਮਣਾ ਚਾਹੁੰਦੇ ਹਾਂ ਉੱਥੇ ਛੇਤੀ ਪਹੁੰਚਾ ਦਿੰਦਾ ਦੂਸਰੀਆਂ ਚੀਜ਼ਾਂ ਪਹਿਲਾਂ ਵਾਲੇ ਟਾਈਮਾਂ ਵਿੱਚ ਟਰੇਨਾਂ ਬਹੁਤ ਜ਼ਿਆਦਾ ਆਵਾਜ਼ ਕਰਦੀਆਂ ਸੀ ਅਤੇ ਟਿਕਟ ਲੈਣ ਲਈ ਵੀ ਦੋ ਦੋ ਤਿੰਨ ਤਿੰਨ ਘੰਟੇ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਸੀ ਪਰ ਅੱਜ ਅਤੇ ਉਹਨਾਂ ਦੀ ਕੰਡੀਸ਼ਨ ਵੀ ਜ਼ਿਆਦਾ ਵਧੀਆ ਨਹੀਂ ਸੀਗੀ ਨਾ ਹੀ ਉਹਨਾਂ ਵਿੱਚ ਖਾਣਾ ਵਧੀਆ ਮਿਲਦਾ ਸੀਗਾ ਅਤੇ ਅੱਜ ਕੱਲ੍ਹ ਦੀਆਂ ਟਰੇਨਾਂ ਵਿੱਚ ਇੱਕ ਤਾਂ ਉਹ ਆਵਾਜ਼ ਨਹੀਂ ਕਰਦੀਆਂ ਵਧੀਆ ਏ ਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਜਲਦੀ ਪੁਜਾ ਦਿੰਦੀਆਂ ਅਤੇ ਤੁਹਾਨੂੰ ਟਿਕਟ ਲੈਣ ਲਈ ਲਾਇਨਾਂ ਵਿੱਚ ਵੀ ਨਹੀਂ ਖੜ੍ਹਨਾ ਪੈਂਦਾ ਹੁਣ ਤੁਸੀਂ ਔਨਲਾਈਨ ਵੀ ਟਿਕਟਾਂ ਬੁੱਕ ਕਰਾ ਸਕਦੇ ਆ ਇਹਨਾਂ ਵਿੱਚ ਬਾਥਰੂਮ ਫਸਿਲਟੀਆਂ ਵੀ ਬਹੁਤ ਵਧੀਆ ਹੁੰਦੀਆਂ ਨੀਟ ਐਂਡ ਕਲੀਨ ਬਾਥਰੂਮ ਖਾਣ ਪੀਣ ਦਾ ਸਮਾਨ ਵੀ ਸਾਰਾ ਵਧੀਆ ਮਿਲੇਗਾ ਅਤੇ ਤੁਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਸੀਟਾਂ ਜਨਰਲ ਵਾਰਡ ਪ੍ਰਾਈਵੇਟ ਵਾਰਡ ਸਿੰਪਲ ਵਾਰਡ ਸੀਟਾਂ ਬੁੱਕ ਕਰਾ ਸਕਦੇ ਹਾਂ ਠੀਕ ਆ ਨਾ ਅਤੇ ਤੁਸੀਂ ਔਨਲਾਈਨ ਬੁਕਿੰਗ ਵੀ ਕਰ ਸਕਦੇ ਆ ਜੀ ਟਿਕਟਾਂ ਦੀ ਅਤੇ ਬਹੁਤ ਜ਼ਿਆਦਾ ਵਧੀਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਹਾਂ ਉੱਥੇ ਸਾਨੂੰ ਜਲਦੀ ਪੁਜਾ ਦਿੰਦੀਆਂ ਮੈਂ ਥੋੜ੍ਹਾ ਹੀ ਟਾਈਮ ਪਹਿਲਾਂ ਇਹ ਪੰਜਾਬ ਤੋਂ ਜੰਮੂ ਦੀ ਬਾਈ ਟਰੇਨ ਸਫਰ ਕੀਤਾ ਜਿਹਦੇ ਵਿੱਚ ਸਫਰ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਟ੍ਰੇਨ ਦੇ ਵਿੱਚ ਮੈਂ ਪ੍ਰਾਈਵੇਟ ਸੀਟ ਬੁੱਕ ਕਰਾਈ ਹੋਈ ਸੀ ਜਿੱਥੇ ਕਿ ਬੈਠਣੇ ਨੇ ਅਲੱਗ ਪੋਸ਼ਨ ਬਣਾਇਆ ਹੋਇਆ ਸੀਗਾ ਅਤੇ ਸੌਣ ਪੈਣ ਲਈ ਅਲੱਗ ਪੋਸ਼ਨ ਬਣਾਇਆ ਹੋਇਆ ਸੀਗਾ ਜਿਸ ਕਰਕੇ ਮੈਨੂੰ ਬਹੁਤ ਵਧੀਆ ਅਤੇ ਆਰਾਮਦਾਇਕ ਫੀਲ ਹੋਇਆ ਅਤੇ ਟਿਕਟਾਂ ਮੈਂ ਔਨਲਾਈਨ ਹੀ ਬੁੱਕ ਕਰਵਾਈਆਂ ਹੋਈਆਂ ਸੀਗੀਆਂ ਜਿਸ ਕਰਕੇ ਮੈਨੂੰ ਜ਼ਿਆਦਾ ਟਾਈਮ ਲੈਨਾ ਵਿੱਚ ਨਹੀਂ ਖੜ੍ਹਨਾ ਪਿਆ ਅਤੇ ਨਾਲ ਹੀ ਮੈਂ ਖਾਣ ਦਾ ਸਮਾਨ ਵੀ ਮੰਗਾਇਆ ਉਹ ਵੀ ਬਹੁਤ ਵਧੀਆ ਸੀਗਾ ਠੀਕ ਆ ਖਾਣ ਦਾ ਸਮਾਨ ਉਹਨਾਂ ਨੇ ਜਿੱਥੇ ਕਿ ਮੇਰਾ ਕੈਬਿਨ ਸੀਗਾ ਉੱਥੇ ਹੀ ਮੈਨੂੰ ਪ੍ਰੋਵਾਈਡ ਕੀਤਾ ਜਿੱਥੇ ਸਫਰ ਦਾ ਜਾਂਦੇ ਹੋਏ ਮੈਨੂੰ ਇੱਕ ਮਿੰਟ ਵੀ ਪਤਾ ਨਹੀਂ ਲੱਗਿਆ ਕਿਹੜੇ ਟਾਈਮ ਮੈਂ ਜੰਮੂ ਤੋਂ ਪੰਜਾਬ ਤੋਂ ਜੰਮੂ ਪਹੁੰਚ ਗਿਆ ਅਤੇ ਮੈਂ ਇਸ ਸਫਰ ਦਾ ਪੂਰਾ ਆਨੰਦ ਮਾਣਿਆ